ਹੈਲੋ ਸਰ ਮੈਂ ਅਤੁਲ ਬੋਲ ਰਿਹਾ ਗੁਰਦਾਸਪੁਰ ਤੋਂ ਮੇਰੇ ਨਾ ਮੰਮਾ ਪਾਪਾ ਦੀ ਕੱਲ੍ਹ ਹੈਗੀ ਹੈ ਟਵੈਂਟੀ ਫਿਫਥ ਐਨੀਵਰਸਰੀ ਇਸ ਕਰਕੇ ਮੈਂ ਸੁਣਿਆ ਕਿ ਤੁਹਾਡਾ ਰੈਸਟੋਰੈਂਟ ਬਹੁਤ ਵਧੀਆ ਸਰਵਿੰਗ ਦਿੰਦਾ ਵਾ ਜਿਸਦੇ ਕਿ ਮੈਂ ਆਪਣੇ ਦੋਸਤ ਨਾਲ ਵੀ ਆਇਆ ਸੀ ਉਹਦੇ ਜਨਮਦਿਨ 'ਤੇ ਅਤੇ ਮੈਂ ਦੇਖਿਆ ਖੁਦ ਵੀ ਆ ਕੇ ਕਿ ਤੁਹਾਡਾ ਰੈਸਟੋਰੈਂਟ ਬਹੁਤ ਵਧੀਆ ਚੀਜ਼ਾਂ ਪ੍ਰੋਵਾਈਡ ਕਰ ਰਿਹਾ ਅਤੇ ਮੈਂ ਸੁਣਿਆ ਹੋਰ ਮੇਰੇ ਭਰਾਵਾਂ ਨੇ ਵੀ ਦੱਸਿਆ ਕਿ ਤੁਹਾਡੇ ਰੈਸਟੋਰੈਂਟ 'ਚ ਚਾਈਨੀਜ਼ ਕਿਊਜ਼ੀਨ ਬਹੁਤ ਵਧੀਆ ਜੋ ਕਿ ਮੇਰੇ ਮਦਰ ਫਾਦਰ ਨੂੰ ਵੀ ਬਹੁਤ ਪਸੰਦ ਹੈ ਅਤੇ ਮੇਰੀ ਸਿਸਟਰ ਨੇ ਵੀ ਸਜੈਸਟ ਕੀਤਾ ਕਿ ਤੁਹਾਡਾ ਰੈਸਟੋਰੈਂਟ ਬਹੁਤ ਵਧੀਆ ਇਸ ਕਰਕੇ ਅਸੀਂ ਤੁਹਾਡੇ ਰੈਸਟੋਰੈਂਟ 'ਚ ਕੱਲ੍ਹ ਇੱਕ ਰਿਜ਼ਰਵੇਸ਼ਨ ਕਰਨਾ ਚਾਹੁੰਦੇ ਹਾਂ ਸ਼ਾਮ ਪੰਜ ਵਜੇ ਦੀ ਪਰ ਅਸੀਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਆ ਤੁਸੀਂ ਸਾਡੇ ਲਈ ਚਾਈਨੀਜ਼ ਕਿਊਜ਼ੀਨ ਵੀ ਰੱਖ ਸਕਦੇ ਹੋ ਅਤੇ ਨਾਲ ਅਸੀਂ ਕੇਕ ਵੀ ਨਹੀਂ ਲੈ ਕੇ ਆਉਣਾ ਤੁਹਾਡੇ ਲਈ ਕੇਕ ਵੀ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਇਸ ਕਰਕੇ ਤੁਸੀਂ ਸਾਨੂੰ ਦੱਸ ਦਿਓ ਕਿ ਸਾਨੂੰ ਰਿਜ਼ਰਵੇਸ਼ਨ ਮਿਲੇਗੀ ਜਾਂ ਨਹੀਂ ਮਿਲੇਗੀ ਇਹ ਇਹ ਥੋੜ੍ਹਾ ਟਾਈਮ ਪਹਿਲਾਂ ਦੱਸ ਦਿਓ ਕਿਉਂਕਿ ਫਿਰ ਅਸੀਂ ਕਿਤੇ ਹੋਰ ਵੀ ਦੇ ਚੈਕਿੰਗ ਕਰ ਲਵਾਂਗੇ ਜੇ ਮਿਲ ਜਾਏਗੀ ਤਾਂ ਇਸੇ ਨੰਬਰ 'ਤੇ ਫੋਨ ਕਰਕੇ ਸਾਨੂੰ ਦੱਸ ਦਿਓ ਉਸ ਤੋਂ ਇਲਾਵਾ ਜੇ ਸਾਨੂੰ ਲੋਕੇਸ਼ਨ ਵੀ ਤੁਸੀਂ ਆਪਣੀ ਮੈਸਜ ਕਰ ਦਿਓ ਥੈਂਕ ਯੂ